ਇੱਕ ਨੈਕਲੈੱਸ ਖਰੀਦਿਆ ਸੀ ਮੈਂ ਉਹ ਬਹੁਤ ਵਧੀਆ ਲੱਗਿਆ ਮੈਨੂੰ ਕਿਉਂਕਿ ਉਹਦਾ ਮਲਟੀਕਲਰ ਸੀਗਾ ਉਹ ਸਾਰੇ ਮੇਰੇ ਕੱਪੜਿਆਂ ਨਾਲ ਸੂਟ ਕਰਦਾ ਸੀਗਾ ਔਰ ਸਭ ਨੂੰ ਪਸੰਦ ਵੀ ਆਉਂਦਾ ਸੀਗਾ ਉਹ